ਮੈਂ ਸ਼ੀਤਲ ਕੁਮਾਰੀ ਮਿਰਜ਼ਾਪੁਰ ਦੀ ਰਹਿਣ ਵਾਲੀ ਹਾਂ ਮੇਰਾ ਜ਼ਿਲ੍ਹਾ ਪਠਾਨਕੋਟ ਹੈ ਮੈਂ ਦੱਸਣਾ ਚਾਹੁੰਦੀ ਹਾਂ ਕਿ ਸ ਸਾਨੂੰ ਸਿਹਤਮੰਦ ਰਹਿਣ ਲਈ ਕੀ ਕੁਝ ਕਰਨਾ ਚਾਹੀਦਾ ਹੈ ਸਾਨੂੰ ਸਿਹਤਮੰਦ ਰਹਿਣ ਲਈ ਸਵੇਰੇ ਉੱਠ ਕੇ ਯੋਗਾ ਕਰਨਾ ਚਾਹੀਦਾ ਹੈ ਯੋਗ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਜੇਕਰ ਅਸੀਂ ਸਵੇਰੇ ਉੱਠ ਕੇ ਸੈਰ ਕਰਦੇ ਹਾਂ ਤਾਂ ਵੀ ਸਾਡਾ ਸਰੀਰ ਅਤੇ ਸਿਹਤ ਤੰਦਰੁਸਤ ਰਹਿੰਦੀ ਹੈ ਜੇਕਰ ਅਸੀਂ ਸਵੇਰੇ ਉੱਠ ਕੇ ਸਾਈਕਲ ਚਲਾਉਂਦੇ ਹਾਂ ਤਾਂ ਵੀ ਅਸੀਂ ਰਿਸ਼ਟ ਪੁਸ਼ਟ ਰਹਿੰਦੇ ਹਾਂ ਜੇਕਰ ਅਸੀਂ ਸਾਡੇ ਵਿੱਚ ਕਾਬਲੀਅਤ ਹੋਵੇ ਤਾਂ ਅਸੀਂ ਦੋ ਚਾਰ ਕਿਲੋਮੀਟਰ ਦੌੜ ਲਗਾ ਲਗਾਈਏ ਤਾਂ ਵੀ ਅਸੀਂ ਤੰਦਰੁਸਤ ਰਹਿੰਦੇ ਹਾਂ ਇਹ ਸਾਰੇ ਉਪਾਏ ਤੰਦਰੁਸਤ ਰਹਿਣ ਦੇ ਹਨ ਇਹਨਾਂ ਦੇ ਨਾਲ ਸਾਡੀ ਸਿਹਤ ਸਹੀ ਰਹਿੰਦੀ ਹੈ ਅਸੀਂ ਕਦੀ ਵੀ ਬਿਮਾਰ ਨਹੀਂ ਹੁੰਦੇ ਅਸੀਂ ਸਮੇਂ ਸਮੇਂ 'ਤੇ ਜੇਕਰ ਇਹ ਕੰਮ ਕਰੀਏ ਅਤੇ ਅਸੀਂ ਆਪਣੇ ਇਲਾਜ ਨਾਲ ਤੁਰਦੇ ਫਿਰਦੇ ਰਹਿੰਦੇ ਹਾਂ ਇਸ ਕਰਕੇ ਮੈਂ ਕਹਿ ਸਕਦੀ ਹਾਂ ਕਿ ਸਾਨੂੰ ਸਮੇਂ ਸਮੇਂ ਦੇ ਸੈਰ ਕਰਨੀ ਚਾਹੀਦੀ ਹੈ ਅਗਰ ਹੋ ਸਕੇ ਤਾਂ ਯੋਗਾ ਕਰਨਾ ਚਾਹੀਦਾ ਹੈ ਜਾਂ ਹੋ ਸਕੇ ਸਾਈਕਲ ਵੀ ਚਲਾਉਣਾ ਚਾਹੀਦਾ ਹੈ ਜਾਂ ਸਾਨੂੰ ਦੌੜ ਵੀ ਲਗਾਉਣੀ ਚਾਹੀਦੀ ਹੈ ਜਾਂ ਸਾਨੂੰ ਘਰ ਦੇ ਭਾਰੇ ਛੋਟੇ ਮੋਟੇ ਕੰਮਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਸਾਡਾ ਸਰੀਰ ਤੰਦਰੁਸਤ ਰਹੇ ਅਤੇ ਅਸੀਂ ਆਪਣੇ ਸਰੀਰ ਦੀ ਤੰਦਰੁਸਤੀ ਲਈ ਇਹਨਾਂ ਕਾਰਨਾਂ ਨੂੰ ਕਰਦੇ ਰਹੀਏ ਧੰਨਵਾਦ ਜੀ